ਮੈਂ ਇੱਕ ਰੇਲਵੇ ਯਾਤਰਾ ਦੀ ਯੋਜਨਾ ਬਣਾਈ ਅਤੇ ਮੈਨੂੰ ਟਿਕਟ ਰੈਜੂਏਸ਼ਨ ਕਰਵਾਉਣੀ ਸੀ ਮੈਨੂੰ ਟਿਕਟ ਰੈਜੂਏਸ਼ਨ ਕਰਵਾਉਣ ਦਾ ਨਹੀਂ ਸੀ ਪਤਾ ਮੈਂ ਇੱਕ ਟਿਕਟ ਰੈਜੂਏਸ਼ਨ 'ਤੇ ਕਾਲ ਕੀਤੀ ਅਤੇ ਉਸ ਨੂੰ ਪੁੱਛਿਆ ਕਿ ਕਿਸ ਤਰ੍ਹਾਂ ਰੈਜੂਏਸ਼ਨ ਹੁੰਦੀ ਹੈ ਰੇਲ ਯਾਤਰਾ ਵਿੱਚ ਮੇਰਾ ਬਹੁਤ ਮਨ ਸੀ ਕਿ ਮੈਂ ਬਾਹਰ ਘੁੰਮਣ ਜਾਵਾਂ